ਮੈਂ ਭਾਰਤ 'ਚ ਰਹਿਣ ਵਾਲਾ ਹਾਂ ਅਤੇ ਸਾਡੇ ਭਾਰਤ ਦੇ ਬਹੁਤ ਹੀ ਮਾੜੇ ਹਾਲਾਤ ਹਨ ਲੁੱਟਾਂ ਖੋਹਾਂ ਨਸ਼ੇ ਚੋਰੀਆਂ ਆਪਣੀਆਂ ਭੈਣਾਂ ਨਾਲ ਰੇਪ ਕੋਈ ਸੁਰੱਖਿਅਤ ਨਹੀਂ ਹੈ ਵੀ ਕੋਈ ਇਹੋ ਜਿਹੀ ਚੀਜ਼ ਕੀਤੀ ਜਾਵੇ ਜਿਹਦੇ ਨਾਲ ਲੁੱਟ ਖੋਹ ਨਾ ਹੋਵੇ ਲੋ ਨਿਆਣੇ ਨਸ਼ੇ ਨਾ ਕਰਨ ਉਹਨਾਂ ਨੂੰ ਕੰਮ ਮਿਲਣ ਕੰਮ ਕਰਨ ਕੰਮ ਮਿਲਣ ਲੁੱਟਾਂ ਖੋਹਾਂ ਬੰਦ ਕਰੋ ਵੀ ਇਹ ਜਿਹੀ ਵੀ ਸਰਕਾਰ ਵੀ ਐਦਾਂ ਕੁਛ ਨਹੀਂ ਕਰ ਰਹੀ ਵੀ ਸਰਕਾਰ ਇਹ ਸਾਰਾ ਕੁਛ ਕਰਨ ਵੀ ਲੁੱਟਾਂ ਖੋਹਾਂ ਵੀ ਬੰਦ ਹੋਣ ਚੋਰੀਆਂ ਵੀ ਬੰਦ ਹੋਣ ਕੋਈ ਜੇ ਸੜਕ ਪਰ ਜਾਂਦਾ ਹੋਵੇ ਕੋਈ ਥੱਪੜ ਮਾਰ ਕੇ ਮੋਟਰਸਾਈਕਲ ਖੋਹ ਲਿਆ ਜਾਂਦਾ ਇਹ ਸਾਰੀਆਂ ਚੀਜ਼ਾਂ ਬੰਦ ਹੋਣ ਸਾਨੂੰ ਸਾਰਿਆਂ ਨੂੰ ਬਹੁਤ ਖੁਸ਼ੀ ਮਿਲਣੀ ਜੇ ਇਹ ਸਾਰਾ ਕੁਝ ਬੰਦ ਹੋ ਗਿਆ ਆਪਾਂ ਨੂੰ ਕਿੰਨਾ ਚਾਅ ਹੋਊਗਾ ਜੇ ਇਹ ਬੰਦ ਹੋ ਗਿਆ ਲੁੱਟਾਂ ਖੋਹਾਂ ਸਪੈਸ਼ਲੀ ਚੋਰੀਆਂ ਵੀ ਆਹ ਰੇਪ ਜਿਹੜੇ ਵਿਚਾਰੇ ਕੁੜੀਆਂ ਹੁੰਦੇ ਇਹ ਸਾਰੇ ਬੰਦ ਹੋਣ